ਕੱਪੜੇ ਇਨਸਾਨ ਦੀ ਬੇਸਿਕ ਨੀਡ ਹੈ ਆਧੁਨਿਕ ਕਾਲ ਵਿੱਚ ਸਿਰਫ ਸਤਨ ਢਕਣ ਲਈ ਕੱਪੜੇ ਦਾ ਯੂਜ ਹੁੰਦਾ ਸੀਗਾ ਪਰੰਤੂ ਆਧੁਨਿਕ ਅੱਜ ਅਜੋਕੇ ਸਮੇਂ ਵਿੱਚ ਕੱਪੜੇ ਦਾ ਯੂਜ ਤਨ ਢਕਣ ਲਈ ਤਾਂ ਹੋ ਰਿਹਾ ਹੀ ਹੋ ਰਿਹਾ ਬਟ ਅੱਜ ਕੱਲ੍ਹ ਦੀ ਜਨਰੇਸ਼ਨ ਨੇ ਇੱਕ ਇਹਨੂੰ ਇੱਕ ਸ਼ੌਂਕ ਦਾ ਸਾਧਨ ਬਣਾ ਲਿਆ ਇੱਕ ਪਰਟੈਂਡਿੰਗ ਦਾ ਸਾਧਨ ਬਣਾ ਲਿਆ ਜਿਸਦੇ ਕਈ ਨੈਗੇਟਿਵ ਇੰਪੈਕਟਸ ਵੀ ਨੇ ਇੱਕ ਤਾਂ ਜੇ ਆਪਾਂ ਦੇਖਿਆ ਜਾਵੇ ਜੇ ਮੈਂ ਜੀਨਸ ਦੀ ਗੱਲ ਕਰਾਂ ਜੀਨ ਇੱਕ ਤਾਂ ਪਹਿਲੀ ਗੱਲ ਬਰੈਂਡਡ ਜਿਹੜਾ ਜੀਨਸ ਹੈਗੀਆਂ ਨੇ ਉਹ ਆਮ ਆਦਮੀ ਦੀ ਸੋਚ ਤੋਂ ਪਰੇ ਨੇ ਲੇਕਿਨ ਸੋਸ਼ਲ ਮੀਡੀਆ ਦੀ ਇਨਫਲੂਐਂਸ 'ਚ ਆ ਕੇ ਬੱਚੇ ਬਰੈਂਡਡ ਜੀਨਾ ਪਿੱਛੇ ਭ ਭੱਜਦੇ ਨੇ ਜਿਸ ਨਾਲ ਮਾਂ ਪਿਓ ਨੂੰ ਬੜੀਆਂ ਔਂਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਤੋਂ ਇਲਾਵਾ ਜਿਸ ਤਰ੍ਹਾਂ ਦੀ ਫਿਟਿੰਗ ਅੱਜ ਕੱਲ੍ਹ ਚੱਲ ਰਹੀ ਹੈ ਫ ਖਾਸ ਕਰਕੇ ਫੀਮੇਲਜ ਦੀ ਉੱਦਾਂ ਵੀ ਮੈਨੂੰ ਲੱਗਦਾ ਕਿ ਥੋੜ੍ਹਾ ਬਹੁਤਾ ਜਨਰੇਸ਼ਨ 'ਤੇ ਥੋੜ੍ਹਾ ਜਿਹਾ ਗਲਤ ਇੰਪੈਕਟ ਪੈਂਦਾ ਅਪਾਰਟ ਫਰੋਮ ਦਿਸ ਜੀਨ ਦੀਆਂ ਜ਼ਿਆਦਾ ਹੀ ਫਿਟਿੰਗ ਕਰਕੇ ਜੋ ਇੱਕ ਖੁੱਲ ਦਾ ਮਾਹੌਲ ਬੱਚਿਆਂ ਨੂੰ ਮਿਲਦਾ ਸੀਗਾ ਉਹ ਤੋਂ ਬੱਚੇ ਵਾਂਝੇ ਰਹਿ ਰਹੇ ਨੇ ਜ਼ਿਆਦਾਤਰ ਬੱਚੇ ਅੱਜ ਕੱਲ੍ਹ ਜਿਹੜੇ ਨਹੀਂ ਕਮਾ ਰਹੇ ਉਹ ਆਪਣੇ ਫਾਦਰ ਮਦਰ ਮਦਰ ਦੀ ਇਨਕਮ ਇਨ ਇਨਕਮ 'ਤੇ ਇਨਫਲੂਐਂਸ ਹੋ ਰਹੇ ਨੇ ਡੋਮੀਨੈਂਸ ਹੋ ਰਹੇ ਨੇ ਅਤੇ ਜਿਹੜੇ ਬੱਚੇ ਕਮਾ ਰਹੇ ਨੇ ਅੱਜ ਕੱਲ੍ਹ ਉਹਨਾਂ ਦਾ ਜਸਟ ਸਾਰਾ ਹੀ ਧਿਆਨ ਸੋਸ਼ਲ ਮੀਡੀਆ ਨੂੰ ਇਨਫਲੂਐਂਸ ਕਰਨ 'ਤੇ ਲੱਗਿਆ ਹੋਇਆ ਸੋਸ਼ਲ ਮੀਲੀਆ ਨੂੰ ਇਨਫਲੂਐਂਸ ਕਿਵੇਂ ਹੁੰਦਾ ਉਹ ਕੱਪੜਿਆਂ ਕਰਕੇ ਹੁੰਦਾ ਸੋ ਅਕੋਰਡਿੰਗ ਟੂ ਮੀ ਜੀਨਸ ਦਾ ਥੋੜ੍ਹਾ ਜਿਹਾ ਨੈਗਟਿਵ ਇਮਪੈਕਸ ਇੰਪੈਕਟ ਹੈਗਾ